ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰਕਸ਼ਾ ਦਾ ਪ੍ਰਬੰਧ ਤੁਹਾਨੂੰ ਪਹਿਲਾਂ ਹੀ ਕਰਨਾ ਚਾਹੀਦਾ ਹੈ ਕਿਉਂਕਿ ਅੰਦਰ ਜਾ ਕੇ ਤੁਹਾਡੇ ਪੈਰ ਜ਼ਮੀਨ 'ਤੇ ਨਹੀਂ ਲੱਗ ਸਕ ਲੱਗਣਗੇ ਅਤੇ ਨਾ ਹੀ ਤੁਹਾਡਾ ਹੱਥ ਕਿਸੇ ਲਾਗੇ ਵਾਲੀ ਚੀਜ਼ ਨੂੰ ਪਵੇਗਾ ਜੇ ਤੁਹਾਨੂੰ ਤੈਰਾਕੀ ਚੰਗੀ ਤਰ੍ਹਾਂ ਆਉਂਦੀ ਹੈ ਤ ਤਾਂ ਹੀ ਖੁੱਲ੍ਹੇ ਪਾਣੀ ਦੇ ਵਿੱਚ ਜਾਇਓ ਨਹੀਂ ਤਾਂ ਆਪਣਾ ਕੋਈ ਸੁਰੱਖਿਆ ਵਾਸਤੇ ਜਿਸ ਤਰ੍ਹਾਂ ਟਿਊਬ ਆ ਜਾਂ ਕੋਈ ਹੋਰ ਚੀਜ਼ ਨਾਲ ਲੈ ਕੇ ਜਾਇਓ ਜਿਹੜੀ ਤਿਲਕਣ ਵਾਲੀਆਂ ਚਟਾਨਾਂ ਐਲਰਜੀ ਐਲਗੀ ਤੇਜ਼ ਵਹਾਅ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਪਹਿਲਾਂ ਮੁਆਇਨਾ ਕਰਕੇ ਜਾਇਓ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਤੱਟ ਦੇ ਉੱਤੇ ਪਹੁੰਚਦੇ ਹੋ ਜਾਂ ਹੱਥ ਲਾਉਂਦੇ ਹੋ ਕਿਤੇ ਐਂ ਨਾ ਹੋਵੇ ਕਿ ਤੁਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਹੱਥ ਤਿਲਕ ਜਾਵੇ ਕਿਉਂਕਿ ਜਿਹੜੀ ਕਾਈ ਜੰਮੀ ਹੁੰਦੀ ਆ ਹਰੇ ਰੰਗ ਦੀ ਉਹ ਵੀ ਤੁਹਾਡੇ ਪੈਰਾਂ ਦੇ ਵਿੱਚ ਅਤੇ ਜ਼ਮੀਨ ਦੇ ਵਿਚਕਾਰ ਜੇ ਉਹ ਕਾਈ ਆ ਗਈ ਤਾਂ ਫਰਿਕਸ਼ਨ ਜਿਹੜੀ ਉਹ ਘਟਾ ਦੇਵੇਗੀ ਅਤੇ ਤੇਜ਼ ਵਹਾਅ ਹੋਇਆ ਉਹਦੇ ਵਾਸਤੇ ਵੀ ਥੋੜ੍ਹਾ ਜਿਹਾ ਤਿਆਰ ਰਹਿਣਾ ਪਵੇਗਾ ਕਿ ਤੁਸੀਂ ਕਿਉੰਕਿ ਵਹਾਅ ਦੇ ਨਾਲ ਹੀ ਚਲੇ ਜਾਉਗੇ ਜੇ ਤੁਹਾਡੇ 'ਚ ਇੰਨਾ ਕੁ ਦਮ ਹੈ ਕਿ ਤੁਸੀਂ ਇੰਨਾ ਕੁ ਚਿਰ ਸਾਹ ਰੋਕ ਸਕਦੇ ਹੋ ਜਾਂ ਇੰਨੀ ਵਧੀਆ ਤਰੀਕੇ ਨਾਲ ਤੈਰਾਕੀ ਕਰ ਸਕਦੇ ਹੋ ਕਿ ਤੁਸੀਂ ਵਹਾਅ ਦੇ ਅਗੇਂਸਟ ਵੀ ਤੈਰਾਕੀ ਕਰ ਲਉਗੇ ਤਾਂ ਫੇਰ ਹੀ ਖੁੱਲ੍ਹੇ ਪਾਣੀ ਦੇ ਵਿੱਚ ਜਾਣਾ ਚਾਹੀਦਾ ਇਹ ਕੁਝ ਰੁਕਾਵਟਾਂ ਜਿਹੜੀਆਂ ਉਹ ਆਉਂਦੀਆਂ ਨੇ ਇਹਨਾਂ ਦਾ ਥੋੜ੍ਹਾ ਖਿਆਲ ਕਰਨਾ ਚਾਹੀਦਾ ਹੈ